ਹੈਲੋ ਹਾਂਜੀ ਮੈਂ ਨਾ ਦਾ ਟੀਚਰ ਬੋਲ ਰਿਹਾਂ ਜੀ ਹੈਲੋ ਅਤੇ ਤੁਹਾਡਾ ਬੱਚਾ ਤੁਹਾਡਾ ਬੱਚਾ ਜਿਹੜਾ ਹੈਗਾ ਮਨਵੀਰ ਸਿੰਘ ਓਹ ਬਿਮਾਰ ਹੋ ਗਿਆ ਹੈਗਾ ਹੈ ਅਤੇ ਉਹਨੂੰ ਵੋ ਵੋ ਵੋਟਿੰਗ ਲੱਗ ਗਈ ਉਲਟੀਆਂ ਲੱਗ ਗਈਆਂ ਹੈਗੀਆਂ ਇਸ ਕਰਕੇ ਬੱਚੇ ਨੂੰ ਤੁਸੀਂ ਆਪਣਾ ਜਿਹੜਾ ਹੈਗਾ ਹੈ ਓਹ ਸਕੂਲ ਤੋਂ ਕਿਸੇ ਵੀ ਤਰੀਕੇ ਆ ਕੇ ਲੈ ਜਾਓ ਕਿਉਂਕਿ ਬੱਚੇ ਦੀ ਜਿਹੜੀ ਕੰਡੀਸ਼ਨ ਹੈਗੀ ਹੈ ਉਹ ਠੀਕ ਨਹੀਂ ਹੈਗੀ ਅਤੇ ਬ ਬੱਚਾ ਸੁਬਾਹ ਤੋਂ ਹੀ ਠੀਕ ਮਹਿਸੂਸ ਨਹੀਂ ਕਰ ਰਿਹਾ ਸੀਗਾ ਅਤੇ ਇਸ ਕਰਕੇ ਬੱਚੇ ਨੂੰ ਅਸੀਂ ਫਸਟ ਏਡ ਦੇਤੀ ਹੈਗੀ ਹੈ ਉਹਨੂੰ ਗਲੂਕੋਸ਼ ਵਗੈਰਾ ਜਿਹੜਾ ਪਾਊਡਰ ਵਗੈਰਾ ਹੈਗਾ ਅਸੀਂ ਉਹਨੂੰ ਦੇਤਾ ਹੈਗਾ ਬੱਚਾ ਇਸ ਟਾਈਮ ਸਾਡੇ ਫਸਟ ਐਡ ਰੂਮ ਜਿਹੜਾ ਹੈਗਾ ਉੱਥੇ ਬਣਾਇਆ ਹੋਇਆ ਉਹਦੇ ਵਿੱਚ ਬੱਚਾ ਪਿਆ ਹੈਗਾ ਇਸ ਕਰਕੇ ਬੱਚੇ ਦਾ ਜਿਹੜਾ ਹੈਗਾ ਹੁਣ ਉਹ ਅਸੀਂ ਚਾ ਚਾਹੁੰਦੇ ਹਾਂ ਕਿ ਬੱਚਾ ਆਪਣੇ ਘਰ ਚਲਾ ਜਾਵੇ ਅਤੇ ਬੱਚਾ ਘਰ ਜਾ ਕੇ ਆਪਣਾ ਮਤਲਬ ਕਿ ਆਰਾਮ ਕਰ ਸਕੇ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਅਸੀਂ ਤਾਂ ਪੂਰਾ ਧਿਆਨ ਰੱਖਿਆ ਜੀ ਤੁਸੀਂ ਮਤਲਬ ਕਿ ਕੋਸ਼ਿਸ਼ ਕਰੋ ਵੀ ਜਲਦੀ ਕੈਬ ਵਗੈਰਾ ਜਾਂ ਜਿੱਦਾਂ ਤੁਸੀਂ ਹੋ ਸਕਦਾ ਤੁਸੀਂ ਆ ਜਾਓ ਬੱਚੇ ਵਾਸਤੇ ਤੁਸੀਂ ਮਤਲਬ ਕਿ ਕੋਈ ਖਾਣ ਵਾਲੀ ਚੀਜ਼ ਨਾਲ ਲੈ ਆਉਣਾ ਤਾਂ ਕਿ ਬੱਚਾ ਮਤਲਬ ਕਿ ਪੇਰੈਂਟਸ ਬੱਚਾ ਆਪਣਾ ਖਾ ਲੈਂਦਾ ਹੈਗਾ ਹਾਂਜੀ ਹਾਂਜੀ ਕੋਈ ਚੀਜ਼ ਬੱਚੇ ਦੇ ਬਹਿ ਬੱਚੇ ਦੇ ਨਾਲ ਹੋ ਸਕੇ ਤਾਂ ਉਹਦੇ ਫਾਦਰ ਸਾਹਬ ਵੀ ਨਾਲ ਹੀ ਆ ਜਾਣ ਜ਼ਿਆਦਾ ਵਧੀਆ ਹੈਗਾ ਹਾਂਜੀ ਹਾਂਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ